ਪੰਜਾਬ ਵਿੱਚ ਬਹੁਤ ਸਾਰੀਆਂ ਜਗਾਵਾਂ ਜਗਾਵਾਂ ਹੈ ਜਿੱਥੇ ਆਪਾਂ ਜਾ ਸਕਦੇ ਹਾਂ ਘੁੰਮ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਬਠਿੰਡੇ ਦਾ ਨਾਮ ਹੀ ਲਵਾਂਗੀ ਕਿਉਂਕਿ ਮੈਂ ਬਠਿੰਡੇ ਤੋਂ ਹੀ ਹਾਂ ਬਠਿੰਡਾ ਸਿਟੀ ਆਫ ਲੇਕਸ ਕਿਹਾ ਜਾਂਦਾ ਕਿਉਂਕਿ ਇੱਥੇ ਲੇਕਸ ਹੈ ਤਾਂ ਮੈਨੂੰ ਲੇਕ ਕੋਲ ਤੁਸੀਂ ਜਾ ਕੇ ਆਪਣਾ ਮਨਪਰਚਾ ਸਕਦੇ ਹੋ ਬੜਾ ਵਧੀਆ ਮੌਸਮ ਰਹਿੰਦਾ ਹੈ ਪਾਣੀ ਕਰਕੇ ਅਤੇ ਨਾਲ ਉੱਥੇ ਖੇਡਣ ਲਈ ਪੈਰਾਗਲਾਈਡਿੰਗ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਤੁਸੀਂ ਅੰਮ੍ਰਿਤਸਰ ਵੀ ਬੜੀ ਅੱਛੀ ਜਗ੍ਹਾ ਹੈ ਕਿਉਂਕਿ ਅੰਮ੍ਰਿਤਸਰ ਸਾਡੇ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਗੋਲਡਨ ਟੈਂਪਲ ਹੈ ਉੱਥੇ ਨਾਲ ਥੀਏਟਰਸ ਵੀ ਹੈ ਨਾਲ ਮੋਲਜ ਵੀ ਹੈ ਜਿੱਥੇ ਤੁਸੀਂ ਆਪਣਾ ਮਨਪਰਚਾ ਸਕਦੇ ਹੋ ਫਿਰ ਇੱਥੇ ਮੋਹਾਲੀ ਮੋਹਾਲੀ ਦਾ ਪਤਾ ਹੀ ਹੈ ਚੰਡੀਗੜ੍ਹ ਦੇ ਨੇੜੇ ਕਰਕੇ ਬੜਾ ਹੀ ਵਧੀਆ ਰਹਿੰਦਾ ਹੈ ਬੜਾ ਹੀ ਵਧੀਆ ਮਾਹੌਲ ਰਹਿੰਦਾ ਹੈ ਖਾਣ ਪੀਣ ਨੂੰ ਵੀ ਵਧੀਆ ਮਿਲ ਜਾਂਦਾ ਹੈ ਅਤੇ ਪੜ੍ਹਾਈ ਲਈ ਵੀ ਬਹੁਤ ਵਧੀਆ ਹੈ ਨਾਲ ਹੀ ਲੁਧਿਆਣਾ ਅਗਰ ਦੇਖੀਏ ਤਾਂ ਲੁਧਿਆਣਾ ਜ਼ਰੂਰ ਰਸ਼ ਬਹੁਤ ਹੁੰਦਾ ਹੈ ਪਰ ਅਗੇਨ ਉੱਥੇ ਖਾਣ ਪੀਣ ਲਈ ਵੀ ਬੜੀ ਵਧੀਆ ਚੀਜ਼ਾਂ ਰਹਿੰਦੀਆਂ ਅਤੇ ਘੁੰਮਣ ਫਿਰਨ ਨੂੰ ਵੀ ਬਹੁਤ ਅੱਛਾ ਹੈ ਜਲੰਧਰ ਜਲੰਧਰ ਤੁਸੀਂ ਵੰਡਰਲੈਂਡ ਦੇਖ ਸਕਦੇ ਹੋ ਸੰਨ ਸਿਟੀ ਦੇਖ ਸਕਦੇ ਹੋ ਅਤੇ ਜਲੰਧਰ ਵੀ ਬੜਾ ਸੁੰਦਰ ਸ਼ਹਿਰ ਹੈ ਬਹੁਤ ਮਜ਼ਾ ਆਉਂਦਾ ਹੈ ਜਲੰਧਰ ਵੀ ਜਾ ਕੇ ਫਿਰ ਪਠਾਨਕੋਟ ਇੱਕ ਬਹੁਤ ਹੀ ਠੰਡਾ ਇਲਾਕਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਪਹਾੜਾਂ ਦੇ ਨੇੜੇ ਆ ਜਾਂਦਾ ਹੈ ਤਾਂ ਇੱਥੇ ਵੀ ਬੜਾ ਜੀ ਲੱਗਦਾ ਹੈ ਬਹੁਤ ਠੰਡਾ ਜਿਹਾ ਸ਼ਹਿਰ ਰਹਿੰਦਾ ਜਲਦੀ ਮੀਂਹ ਪੈ ਜਾਂਦਾ ਤਾਂ ਬੜਾ ਸੁੰਦਰ ਲੱਗਦਾ ਹੈ ਇਹ ਫਰੀਦਕੋਟ ਵੀ ਬੜਾ ਵਧੀਆ ਸ਼ਹਿਰ ਹੈ ਫਰੀਦਕੋਟ ਬਾਬਾ ਫਰੀਦ ਜੀ ਦੀ ਧਰਤੀ ਹੈ ਕਹਿੰਦੇ ਆ ਬਾਬਾ ਫਰੀਦ ਜੀ ਦੇ ਨਾਮ ਤੋਂ ਹੀ ਫਰੀਦਕੋਟ ਦਾ ਨਾਮ ਪਿਆ ਹੈ ਤਾਂ ਫਰੀਦਕੋਟ ਵੀ ਘੁੰਮਣ ਲਈ ਜੇ ਆਪਾਂ ਦੇਖੀਏ ਤਾਂ ਕੋਈ ਇੰਨਾ ਖਾਸ ਨਹੀਂ ਹੈ ਪਰ ਉੱਥੇ ਮਨ ਬੜਾ ਲੱਗਦਾ ਹੈ ਕਿਉਂਕਿ ਮੇਰਾ ਪਿਛੋਕੜ ਫਰੀਦਕੋਟ ਤੋਂ ਹੀ ਹੈ